ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੌਸਮ ਬਹੁਤ ਵਧੀਆ ਹੈ ਇੱਥੇ ਮੌਸਮ ਟਾਈਮ ਦੇ ਨਾਲ ਨਾਲ ਬਦਲਦਾ ਰਹਿੰਦਾ ਹੈ ਕਦੇ ਗਰਮੀ ਪੈਂਦੀ ਹੈ ਕਦੇ ਸਰਦੀ ਪੈਂਦੀ ਹੈ ਪੱਤਝੜ ਬਸੰਤ ਆਦਿ ਵਰਗੇ ਰੁੱਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰੰਤੂ ਇਹਨਾਂ ਰੁੱਤਾਂ ਨੂੰ ਹਰ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਕੁਝ ਲੋਕਾਂ ਦਾ ਇਨ੍ਹਾਂ ਰੁੱਤਾਂ ਵਿੱਚ ਬਹੁਤ ਨੁਕਸਾਨ ਹੁੰਦਾ ਹੈ ਜਿਵੇਂ ਸਰਦੀਆਂ ਵਿੱਚ ਨੁਕਸਾਨ ਹੁੰਦੇ ਹਨ ਸਰਦੀਆਂ ਵਿੱਚ ਲੋਕ ਸੜਕਾਂ ਉੱਪਰ ਜਾਂਦੇ ਹਨ ਬਹੁਤ ਧੁੰਦ ਹੋਣ ਦਾ ਕਰਕੇ ਆਵਾਜਾਈ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਸੜਕਾਂ ਉੱਤੇ ਬਹੁਤ ਸਾਰੇ ਜਾਨੀ ਨੁਕ ਨੁਕਸਾਨ ਵੀ ਹੁੰਦੇ ਹਨ ਗਰਮੀਆਂ ਵਿੱਚ ਕੰਮ ਕੰਮ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਕੁਝ ਲੋਕ ਜਦੋਂ ਗਰਮੀਆਂ ਵਿੱਚ ਕੰਮ ਕਰ ਰਹੇ ਹੁੰਦੇ ਹਨ ਤਾਂ ਜ਼ਿਆਦਾ ਗਰਮੀ ਹੋਣ ਦੇ ਕਾਰਨ ਉਹ ਬਿਮਾਰ ਹੋ ਜਾਂਦੇ ਹਨ ਚੱਕਰ ਆ ਜਾਂਦੇ ਹਨ ਇਸ ਕਰਕੇ ਉਹਨਾਂ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਆ ਗਰਮੀਆਂ ਵਿੱਚ ਵੀ ਸਰਦੀਆਂ ਵਿੱਚ ਵੀ